ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਨਾਮ ਹੈ ਇਹ ਬਹੁਤ ਸੋਹਣਾ ਜ਼ਿਲ੍ਹਾ ਹੈ ਪਹਿਲਾਂ ਇਹਦਾ ਨਾਮ ਨਵਾਂਸ਼ਹਿਰ ਸੀ ਉਸ ਤੋਂ ਬਾਅਦ ਇਹਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਸ਼ਹੀਦ ਭਗਤ ਸਿੰਘ ਰੱ ਨਗਰ ਰੱਖਿਆ ਗਿਆ ਇਹ ਦੇ ਲਾਗੇ ਹੀ ਪਿੰਡ ਭਗਤ ਸਿੰਘ ਦਾ ਪਿੰਡ ਹੈ ਖਟਕੜ ਕਲਾਂ ਜਿਹਦੇ ਕਰਕੇ ਕਾਫ਼ੀ ਜਾਣਿਆ ਜਾਂਦਾ ਹੈ ਇੱਥੇ ਗੁਰਦੁਆਰਾ ਟਿੱਬੀ ਸਾਹਿਬ ਜੋ ਕਿ ਕਾਫ਼ੀ ਮਸ਼ਹੂਰ ਹੈ ਉਹਦੇ ਨਾਲ ਹੀ ਬੈਕ ਸਾਈਡ 'ਤੇ ਇੱਕ ਗੁਰੂ ਰਿਆਤ ਕਾਲਜ ਹੈ ਜਿੱਥੇ ਯੂਨੀਵਰਸਿਟੀ ਵੀ ਹੈ ਉਹ ਵੀ ਇੱਥੇ ਨਵਾਂਸ਼ਹਿਰ 'ਚ ਪ੍ਰਚਲਿਤ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਸ ਤਰ੍ਹਾਂ ਕਿ ਸਰਕਾਰੀ ਹੋਸਪੀਟਲ ਬਹੁਤ ਵਧੀਆ ਹੈ ਬਹੁਤ ਵਧੀਆ ਟ੍ਰੀਟਮੈਂਟ ਚੱਲਦਾ ਹੈ ਹੁਣ ਕਾਫ਼ੀ ਨਵੇਂ ਜਿਸ ਤਰ੍ਹਾਂ ਕਿ ਬ੍ਰਿਜ ਹਾਈਵੇ ਨਿਕਲੇ ਨੇ ਉੱਥੇ ਨਵਾਂਸ਼ਹਿਰ ਦਾ ਬਹੁਤ ਸੋਹਣਾ ਹਾਈਵੇ ਪਾਸ ਕੀਤਾ ਗਿਆ ਉਸ ਤੋਂ ਇਲਾਵਾ ਇੱਥੇ ਕਾਫ਼ੀ ਜੁੱਤੀਆਂ ਦੀ ਕਾਰਾਗਿਰੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਪਰਾਂਦੇ ਜੁੱਤੀਆਂ ਆਪ ਬਣਾਏ ਜਾਂਦੇ ਨੇ ਇੱਥੇ ਬਹੁਤ ਸਾਰੇ ਸਰਕਾਰੀ ਸਕੂਲ ਕਾਲਜ ਕਾਫ਼ੀ ਯੂਨੀਵਰਸਿਟੀਆਂ ਅਨ ਪ੍ਰਚਲਿਤ ਨੇ ਇਸ ਤੋਂ ਇਲਾਵਾ ਇੱਥੇ ਕਾਫ਼ੀ ਚੀਜ਼ਾਂ ਜਿਸ ਤਰ੍ਹਾਂ ਕਿ ਕ ਕੰਮ ਆਪ ਕੀਤੇ ਜਾਂਦੇ ਨੇ ਜੁੱਤੀਆਂ ਦਾ ਕੰਮ ਆਪ ਕੀਤਾ ਜਾਂਦਾ ਹੈ ਇੱਥੇ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਕਰਕੇ ਵੀ ਕਾਫ਼ੀ ਮਸ਼ਹੂਰ ਹੈ ਇੱਥੋਂ ਦੇ ਬਾਜ਼ਾਰ ਅਤੇ ਬਹੁਤ ਰੌਣਕਾਂ ਨੇ ਹਰੇਕ ਚੀਜ਼ ਵਧੀਆ ਤਰੀਕੇ ਨਾਲ ਵਧੀਆ ਚੀਜ਼ ਮਿਲਦੀ ਹੈ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਬਹੁਤ ਵਧੀਆ ਹੈ ਨਵਾਂ ਸ਼ਹੀਦ ਭਗਤ ਸਿੰਘ ਨਗਰ ਇੱਕ ਜ਼ਿਲ੍ਹਾ ਹੈ ਜੋ ਕਿ ਬਹੁਤ ਵਧੀਆ ਹੈ ਹੀ ਹੈ